ਤੁਸੀਂ ਮਿਊਜਿਕ ਟੀਚਰ ਬੋਲਦੇ ਪਏ ਜੀ ਕੋਮਲਪ੍ਰੀਤ ਕੌਰ ਅਤੇ ਮੈਮ ਮੈਂ ਤੈਨੂੰ ਜਾਣ ਲੈਣਾ ਚਾਹੁੰਦੀ ਹਾਂ ਕਿ ਆਪਣੇ ਪੰਜਾਬ ਦੇ ਮਿਊਜਿਕ ਫੇਮਸ ਮਿਊਜਿਕ ਕੀ ਕੌਣ ਹੈਗੇ ਨੇ ਸਿੰਗਰ ਹਾਂਜੀ ਹਾਂਜੀ

ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਠੀਕ ਮੈਮ ਅਤੇ ਮੈਮ ਤੁਹਾਡੇ ਫੇਵਰੇਟ ਸਿੰਗਰ ਕੌਣ ਨੇ ਓਕੇ ਹਾਂਜੀ ਮੈਮ ਹਾਂਜੀ ਮੈਮ ਸ਼ੋਅ ਹੀ ਕਰਵਾਉਣਾ ਸੀਗਾ

ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂ ਓਕੇ ਮੈਮ ਹਾਂਜੀ ਓਕੇ